ਤਕਨੀਕੀ ਵਾਧੇ ਦੇ ਨਾਲ ਆਉਣ ਵਾਲੇ ਸਾਲਾਂ ਵਿੱਚ ਸਾਡੀ ਜ਼ਿੰਦਗੀ ਬਦਲ ਜਾਊਗੀ ਕਾਰਾਂ ਦੀ ਟਕਨੀਕ ਦੇ ਵਿੱਚ ਨਵੀਨਤਾ ਆਉਣ ਦੇ ਨਾਲ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਏਗਾ ਇਸ ਨਾਲ ਰਸਤਿਆਂ ਦੀ ਭਾਲ ਕਰਨੀ ਅਤੇ ਕਾਰਾਂ ਨੂੰ ਚਲਾਉਣ ਦਾ ਚਲਾਉਣ ਦੇ ਵਿੱਚ ਵੀ ਕੋਈ ਔਕੜ ਨਹੀਂ ਆਵੇਗੀ ਇਸ ਤੋਂ ਇਲਾਵਾ ਡਰਾਈਵਰ ਤੋਂ ਰਹਿਤ ਕਾਰਾਂ ਵੀ ਸਾਡੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਜ਼ਿੰਦਗੀ ਨੂੰ ਆਸਾਨ ਬਣਾ ਦੇਣਗੀਆਂ ਰੋਬਟ ਸਿਸਟਮ ਦੇ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਕਰਨ ਦੇ ਵਿੱਚ ਆਸਾਨੀ ਹੋਊਗੀ ਅਤੇ ਗੰਭੀਰ ਬਿਮਾਰੀਆਂ ਨੂੰ ਆਸਾਨੀ ਦੇ ਨਾਲ ਅਤੇ ਸਮੇਂ ਦੇ ਰਹਿੰਦੇ ਹੀ ਠੀਕ ਕੀਤਾ ਜਾ ਸਕੂਗਾ ਮੋਬਾਈਲ ਫੋਨ ਜੋ ਕਿ ਸਾਨੂੰ ਅਡਵਾਂਸ ਸੂਚਨਾ ਦੇ ਕੇ ਸਾਡੀ ਜ਼ਿੰਦਗੀ ਨੂੰ ਸੌਖਾ ਕਰਨ ਦੇ ਵਿੱਚ ਮਦਦ ਕਰਨਗੇ ਵੀਡੀਓ ਕਾਲਿੰਗ ਦੀ ਸੁਵਿਧਾ ਦੇ ਨਾਲ ਆਪਸ ਦੀ ਦੂਰੀ ਘੱਟ ਜਾਏਗੀ ਅਤੇ ਅਸੀਂ ਲੱਖਾਂ ਕਿਲੋਮੀਟਰਾਂ 'ਤੇ ਬੈਠੇ ਬੰਦੇ ਨਾਲ ਵੀ ਸਾਹਮਣੇ ਬੈਠੇ ਹੋਏ ਦੀ ਤਰੀਕੇ ਨਾਲ ਗੱਲ ਕਰ ਸਕਾਂਗੇ ਏਆਈ ਸਿਸਟਮ ਦੇ ਨਾਲ ਕਈ ਸੇਵਾਵਾਂ ਤੁਹਾਡੇ ਹੱਥ ਦੇ ਵਿੱਚ ਹੀ ਆ ਜਾਣਗੀਆਂ ਅਤੇ ਜ਼ਿੰਦਗੀ ਦੇ ਵਿੱਚ ਦੂਸਰੇ ਇਨਸਾਨਾਂ ਦੇ ਉੱਪਰ ਨਿਰਭਰਤਾ ਘੱਟ ਜਾਏਗੀ ਇਸ ਤਰੀਕੇ ਦੇ ਨਾਲ ਟੈਕਨੋਲੋਜੀ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਅਸਰ ਪਾਏਗੀ